ਹੈਲੋ ਸਰ ਤੁਸੀਂ ਓਲਾ ਐਪ ਵਿੱਚੋਂ ਬ ਕੋਈ ਵੀ ਕੈਬ ਸਾਡੇ ਲਈ ਭੇਜ ਸਕਦੇ ਹੋ ਕਿਉਂਕਿ ਅਸੀਂ ਫੰਕਸ਼ਨ 'ਤੇ ਖ ਅਸੀਂ ਇੱਕ ਫੰਕਸ਼ਨ 'ਚ ਗਏ ਸੀ ਅਤੇ ਅਸੀਂ ਉੱਥੇ ਖੜੇ ਹਾਂ ਤਾਂ ਅਸੀਂ ਬਹੁਤ ਰਾਤ ਹੋ ਗਈ ਹੈ ਅਸੀਂ ਬਹੁਤ ਜ਼ਿਆਦਾ ਕੁੜੀਆਂ ਹਨ ਅਤੇ ਸਾਨੂੰ ਇੱਕ ਕੈਬ ਦੀ ਜ਼ਰੂਰਤ ਹੈ ਘਰ ਪਹੁੰਚਣ ਲਈ ਤਾਂ ਪਲੀਜ਼ ਸਾ ਮੈਨੂੰ ਤੁਹਾਡੀ ਐਪ ਵਿੱਚ ਐਪ ਦੇ ਰਾਹੀਂ ਮੈਨੂੰ ਇੱਕ ਕੈਪ ਕੈਪ ਬੁੱਕ ਕੀਤੀ ਜਾਵੇ ਅਤੇ ਉਸਦਾ ਡਰਾਈਵਰ ਬਹੁਤ ਹੀ ਜ਼ਿਆਦਾ ਡੀਸੈਂਟ ਬਹੁਤ ਸਿਆਣਾ ਅਤੇ ਬਹੁਤ ਸਮਝਦਾਰ ਹੋਵੇ ਤਾਂ ਕਿ ਅਸੀਂ ਉਸ ਨਾਲ ਸੁਰੱਖਿਅਤ ਫੀਲ ਕਰੀਏ ਅਤੇ ਸਾਨੂੰ ਵਧੀਆ ਹੀ ਚੰਗੇ ਤਰੀਕੇ ਨਾਲ ਬਿਨਾਂ ਕਿਸੇ ਡਰ ਤੋਂ ਸਾਨੂੰ ਸਾਡੇ ਘਰ ਪਹੁੰਚਾ ਦਿੱਤਾ ਜਾਵੇ ਅਤੇ ਜੋ ਤੁਹਾਡਾ ਰੇਟ ਆ ਜੋ ਤੁਸੀਂ ਪੈਸੇ ਲਵੋਗੇ ਸਾਨੂੰ ਪਲੀਜ਼ ਦੱਸੋ ਅਤੇ ਅਸੀਂ ਇੱਥੇ ਇੰਤਜ਼ਾਰ ਕਰ ਰਹੇ ਹਾਂ ਤਾਂ ਕਿ ਤੁਸੀਂ ਆ ਕੇ ਸਾਨੂੰ ਲੈ ਜਾਓ ਅਤੇ ਤੁਸੀਂ ਉਸ ਉਸ ਡਰਾਈਵਰ ਨੂੰ ਪਲੀਜ਼ ਜਲਦੀ ਤੋਂ ਜਲਦੀ ਭੇਜਣ ਦੀ ਕਿਰਪਾਲਤਾ ਕਰੋ ਤਾਂ ਕਿ ਅਸੀਂ ਉਹ ਹੱਦ ਤੋਂ ਵੱਧ ਜ਼ਿਆਦਾ ਟਾਈਮ ਨਾ ਇੱਥੇ ਰਹੀਏ ਅਤੇ ਜਲਦੀ ਤੋਂ ਜਲਦੀ ਘਰ ਪਹੁੰਚੀਏ ਅਤੇ ਉਹ ਡਰਾਈਵਰ ਪਲੀਜ਼ ਨਸ਼ਾ ਪੱਤਾ ਨਾ ਕੀਤਾ ਹੋਵੇ ਵਧੀਆ ਸਿਆਣਾ ਹੋਵੇ ਅਤੇ ਗਲਤ ਨਿਗ੍ਹਾ ਨਾਲ ਕਿਸੇ ਵੀ ਕੁੜੀ ਵੱਲ ਨਾ ਦੇਖਦਾ ਹੋਵੇ ਅਤੇ ਹਰ ਇੱਕ ਕੁੜੀ ਨੂੰ ਇੱਜ਼ਤ ਕਰਦਾ ਹੋਵੇ ਅਤੇ ਉਹ ਗਲਤ ਕੋਈ ਗਲਤ ਇਰਾਦਾ ਉਸਦਾ ਗਲਤ ਮਕਸਦ ਨਾ ਹੋਵੇ ਅਤੇ ਸਾਨੂੰ ਘਰ ਪਹੁੰਚਾ ਦਿੱਤਾ ਜਾਵੇ ਅਤੇ ਤੁਹਾਡੀ ਕੈਪ ਸਾਨੂੰ ਜੋ ਕੈਪ ਵਧੀਆ ਹੋਵੇ ਉਸ ਕੈਪ ਨੂੰ ਭੇਜੋ ਜੋ ਪੈਸਾ ਹੋਵੇਗਾ ਅਸੀਂ ਤੁਹਾਨੂੰ ਦੇਵਾਂਗੇ ਸਾਨੂੰ ਉਸ ਪੈਸੇ ਪੈਸਾ ਕਿੰਨਾ ਹੋਵੇਗਾ ਸਾਨੂੰ ਦੱਸਿਆ ਜਾਵੇ